ਹੈਲੋ ਹਾਂਜੀ ਨਹੀਂ ਮੈਂ ਬੰਦ ਦੇ ਕੇ ਗਈ ਹਾਂ ਪਾਰਸਲ ਨਹੀਂ ਨਹੀਂ ਮੈਮ ਮੈਂ ਪਾਰਸਲ ਬੰਦ ਦੇ ਕੇ ਗਈ ਹਾਂ ਨਹੀਂ ਨਹੀਂ ਨਹੀਂ ਨਹੀਂ ਮੈਂ ਬੰਦ ਦੇ ਕੇ ਗਈ ਹਾਂ ਨਹੀਂ ਨਹੀਂ ਜੇ ਤੁਸੀਂ ਵੀਡੀਓ ਬਣਾਉਣੀ ਸੀ ਨਹੀਂ ਨਹੀਂ ਮੈਂ ਤਾਂ ਬੰਦ ਕੇ ਗਈ ਹਾਂ ਮੈਮ ਨ ਨਹੀਂ ਨਹੀਂ ਮੈਮ ਮੈਂ ਬੰਦ ਕੇ ਗਈ ਹਾਂ ਤੁਹਾਡੇ ਕੋਲੋਂ ਕੋਈ ਗਲਤੀ ਹੋਈ ਹੋਣੀ ਆ ਨਹੀਂ ਨਹੀਂ ਮੈਮ ਮੈਂ ਤਾਂ ਨਹੀਂ ਮੈਂ ਬੰਦ ਕੇ ਗਈ ਹਾਂ ਨਹੀਂ ਕੀਤੀ ਸਾਨੂੰ ਜਿਵੇਂ ਪਾਰਸਲ ਆਇਆ ਸੀ ਅਸੀਂ ਉਵੇਂ ਹੀ ਡਿਲੀਵਰ ਕੀਤਾ ਨਹੀਂ ਨਹੀਂ ਨਹੀਂ ਮੈਮ ਮੈਂ ਨਹੀਂ ਖਰਾਬ ਕੀਤਾ ਨਹੀਂ ਨਹੀਂ ਤੁਹਾਡੇ ਕੋਲ ਹੀ ਗਲਤੀ ਹੋਈ ਹੈ ਸਾਡੇ ਕੋਲ ਕੋਈ ਗਲਤੀ ਨਹੀਂ ਹੋਈ ਪਾਰਸਲ ਵੀ ਸਹੀ ਆਇਆ ਸੀ ਨਹੀਂ ਨਹੀਂ ਮੈਮ ਤੁਹਾਡੇ ਕੋਲ ਗਲਤੀ ਹੋਈ ਹੈ ਸਾਡੇ ਕੋਲੋਂ ਕੋਈ ਗਲਤੀ ਨਹੀਂ ਹੋਈ ਤੁਸੀਂ ਐਵੇਂ ਨਾ ਕਰੋ ਤੁਸੀਂ ਪਾਰਸਲ ਮੰਗਵਾਇਆ ਸੀ ਅਤੇ ਅਸੀਂ ਸਹੀ ਦੇ ਕੇ ਗਏ ਹਾਂ ਤੁਹਾਡੇ ਕੋਲੋ ਗਲਤੀ ਹੋਈ ਆ ਨਹੀਂ ਨਹੀਂ ਨਹੀਂ ਨਹੀਂ ਚਲੋ ਸੋਰੀ ਜੇ ਹੋਇਆ ਐਵੇਂ ਤਾਂ ਵੈਸੇ ਸਾਡੇ ਕੋਲੋਂ ਹੋਇਆ ਨਹੀਂ ਪਰ ਫਿਰ ਵੀ ਅਸੀਂ ਮਾਫੀ ਮੰਗਦੇ ਹਾਂ ਇਸ ਚੀਜ਼ ਵਾਸਤੇ ਅਤੇ ਅੱਗੇ ਤੋਂ ਐਵੇਂ ਨਹੀਂ ਹੋਏਗਾ ਹਾਂਜੀ ਸਾਡੇ ਕੋਲੋਂ ਵੈਸੇ ਐਵੇਂ ਨਹੀਂ ਹੋਇਆ ਪਰ ਫਿਰ ਵੀ ਅਸੀਂ ਮਾਫੀ ਮੰਗਦੇ ਹਾਂ ਨਹੀਂ ਚਲੋ ਮੈਮ ਸੋਰੀ ਅੱਗੇ ਤੋਂ ਵੇਖਦੇ ਹਾਂ ਅਸੀਂ ਧਿਆਨ ਰੱਖਾਂਗੇ ਇਸ ਚੀਜ਼ ਦਾ ਠੀਕ ਹੈ